ਹਾਂ ਮੈਂ ਵੋਇਸ ਟੂ ਟੈਸਟ ਸੇਵਾ ਜਾਂ ਐਪ ਦੀ ਵਰਤੋਂ ਕੀਤੀ ਹੈ ਅਤੇ ਇਸ ਇਹ ਕਾਫੀ ਸੁਵਿਧਾਜਨਕ ਹੈ ਹੈ ਹੋ ਸਕਦਾ ਹੈ ਖਾਸ ਕਰਕੇ ਜਦੋਂ ਤੁਸੀਂ ਆਪਣੇ ਹੱਥਾਂ ਨੂੰ ਵਿਅਸਤ ਰੱਖਦੇ ਹੋ ਜਾਂ ਜਦੋਂ ਤੇਜ਼ੀ ਨਾਲ ਲਿਖਣਾ ਪੈਂਦਾ ਹੈ ਇਸ ਸੇਵਾ ਇਹ ਸੇਵਾ ਮੈਨੂੰ ਆਪਣਾ ਆਪਣੇ ਵਿਚਾਰਾਂ ਨੂੰ ਬਿਨਾਂ ਕਿਸੇ ਤਕਲੀਫ ਦੇ ਸਿੱਧਾ ਦਸਤਾਵੇਜ਼ ਦੇ ਸੁਨੇਹੇ ਵਿੱਚ ਤਬਦੀਲ ਕਰਨ ਦੀ ਆਗਿਆ ਦਿੰਦੀ ਹੈ ਇਸ ਨੂੰ ਵ ਵਰਤਣ ਤੋਂ ਪਹਿਲਾਂ ਮੈਂ ਆਪਣੇ ਵਿਚਾਰਾਂ ਨੂੰ ਬੋਲ ਕੇ ਉਹਨਾਂ ਨੂੰ ਟੈਸ ਟੈਕਸਟ ਵਿੱਚ ਦਰਜ ਕਰਦਾ ਹਾਂ ਜਿਸ ਨਾਲ ਮੇਰੇ ਲਈ ਸਮਾਂ ਬਚਦਾ ਹੈ ਅਤੇ ਮੈਨੂੰ ਲਿਖਣ ਦੀ ਲੋੜ ਨਹੀਂ ਪੈਂਦੀ ਜਦੋਂ ਇਸ ਇਹਨੂੰ ਇਸ ਇਸ ਨੂੰ ਸੁਵੀ ਧਾਨਕ ਬਣਾਇਆ ਵਾਲੀਆਂ ਚੀਜ਼ਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਮੈਂ ਆਪਣੇ ਵਿੱਚ ਵਿਚਾਰ ਤੁਰੰਤ ਕਾਗਜ਼ 'ਤੇ ਲਿਖ ਸਕਦਾ ਲਿਖ ਲਿਆ ਲਿਖਿਆ ਜਾ ਸਕਦਾ ਹੈ ਇਸ ਨੂੰ ਮੋਬਾਈਲ ਜਾਂ ਕੰਪਿਊਟਰ ਅਤੇ

ਕੁਝ ਹਾਲਾਤਾਂ ਵਿੱਚ ਇਹ ਸੇਵਾ ਅਸੁਵਿਧਾਜਨਕ ਹੈ ਸਗੋਂ ਹੋ ਸਕਦੀ ਹੈ ਜਿਵੇਂ ਕਿ ਜਦੋਂ ਇਹਨੂੰ ਸ਼ਬਦਾਂ ਨੂੰ ਸਹੀ ਤਰੀਕੇ ਨਾਲ ਸਮਝਣ ਵਿੱਚ ਮੁਸ਼ਕਿਲ ਆਉਂਦੀ ਹੈ ਜਾਂ ਬੋਲਚਾਲ ਵਿੱਚ ਕੋਈ ਸਬਜ਼ ਜਾਂ ਅਚਾਨਕ ਧੁਲ ਦੀ ਆਵਾਜ਼ ਹੋਵੇ ਇਸ ਤਰ੍ਹਾਂ ਕਈ ਵਾਰ ਇਹ ਅ ਅਪੈਲਡ ਐਪੀਲੈਕਸ ਸ਼ਬਦਾਂ ਨੂੰ ਗਲਤ ਤਰੀਕੇ ਨਾਲ ਦਰਜ ਕਰਦਾ ਹੈ ਜਿਸ ਕਾਰਨ ਹੁਣ ਮੈਨੂੰ ਸਕਸ਼ਤ ਕਰਨੀ ਪੈਂਦੀ ਹੈ ਧੰਨਵਾਦ